ਸਾਈਕਲ ਚਲਾਉਣਾ ਮਤਲਬ ਛੋਟੇ ਹੁੰਦੇ ਅਸੀਂ ਸਾਈਕਲ ਚਲਾਉਂਦੇ ਹੁੰਦੇ ਸੀ ਹੁਣ ਤਾਂ ਚਲੋ ਕਾਫ਼ੀ ਉਮਰ ਹੋ ਗਈ ਹੈ ਫਿਰ ਵੀ ਅਸੀਂ ਕਦੇ ਨਾ ਕਦੇ ਸਾਈਕਲ ਫਿਰ ਵੀ ਚਲਾਉਂਦੇ ਹਾਂ ਸਾਈਕਲ ਚਲਾਉਣ ਵੇਲੇ ਕੋਈ ਖ਼ਾਸ ਦਸਤਾਵੇਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਪਰ ਆਪਣੇ ਕੋਲ ਆਧਾਰ ਕਾਰਡ ਔਰ ਕੋਂਟੈਕਟ ਨੰਬਰ ਫ਼ੋਨ ਦਾ ਹੋਣਾ ਚਾਹੀਦਾ ਹੈ ਜੇਕਰ ਰਸਤੇ ਵਿੱਚ ਕੁਛ ਇਹੋ ਜਿਹੀ ਸਾਡੇ ਨਾਲ਼ ਵਾਪਰ ਜਾਵੇ ਕੋਈ ਹਾਦਸਾ ਵਾਪਰ ਜਾਵੇ ਤਾਂ ਹੀ ਘਰਦਿਆਂ ਦੇ ਨਾਲ਼ ਕੀ ਹੈ ਕੋਂਟੈਕਟ ਕੀਤਾ ਜਾ ਸਕੇ ਬਾਕੀ ਸਾਈਕਲ ਚਲਾਉਣ ਲੱਗਿਆਂ ਸਾਨੂੰ ਆਪਣੇ ਕੂਹਣੀਆਂ ਦੇ ਉੱਤੇ ਔਰ ਗੋਡਿਆਂ ਦੇ ਉੱਤੇ ਜਿਹੜੇ ਨੀਅ ਪੈਡ ਜਿਹੜੇ ਪਾਉਣੇ ਚਾਹੀਦੇ ਹੈ ਸਿਰ 'ਤੇ ਹੈਲਮਟ ਪਾਉਣਾ ਚਾਹੀਦਾ ਹੈ ਜਿਸ ਨਾਲ਼ ਕਿ ਅਸੀਂ ਮਤਲਬ ਕਿ ਇਹੋ ਜਿਹੀਆਂ ਹਾਦਸਿਆਂ ਤੋਂ ਬਚ ਸਕੀਏ ਤੋ ਇਸ ਕਰਕੇ ਸਾਈਕਲ ਯਾਤਰਾ ਜਿਹੜੀ ਹੈ ਸਭ ਤੋਂ ਹੀ ਮਤਲਬ ਖਰਚੇ ਰਹਿਤ ਹੈ ਕੋਈ ਖਰਚਾ ਨਹੀਂ ਲੱਗਦਾ ਕੋਈ ਪੈਟਰੋਲ ਨਹੀਂ ਲੱਗਦਾ ਕੋਈ ਡੀਜ਼ਲ ਨਹੀਂ ਲੱਗਦਾ ਅਤੇ ਸਾਈਕਲ ਦੀ ਯਾਤਰਾ ਸਾਨੂੰ ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦੀ ਹੈ